ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰੀਆ ਸ਼ਰਮਾ ਹੈ ਅਤੇ ਮੈਂ ਮੋਹਾਲੀ ਜ਼ਿਲ੍ਹੇ ਤੋਂ ਗੱਲ ਕਰ ਰਹੀ ਹਾਂ ਕੁਝ ਦਿਨਾਂ ਪਹਿਲਾਂ ਮੈਂ ਤੁਹਾਡੇ ਸਟੋਰ ਤੋਂ ਔਰਡਰ ਕਿਤ ਔਰਡਰ ਦਿੱਤਾ ਸੀ ਪਰ ਮੇਰੇ ਨਿੱਜੀ ਕਾਰਨਾਂ ਕਰਕੇ ਮੈਨੂੰ ਉਹ ਔਰਡਰ ਰੱਦ ਕਰਨਾ ਪਿਆ ਸੀ ਮੈਨੂੰ ਹੁਣ ਤੱਕ ਉਸ ਔਰਡਰ ਦੇ ਪੈਸੇ ਰਿਫੰਡ ਨਹੀਂ ਕੀਤੇ ਗਏ ਕਿਰਪਾ ਕਰਕੇ ਮੇਰੇ ਪੈਸੇ ਰਿਫੰਡ ਨਾ ਹੋਣ ਦਾ ਕਾਰਨ ਦੱਸਿਆ ਜਾਵੇ ਅਤੇ ਹਾਂ ਜੋ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਮੇਰੇ ਪੈਸੇ ਸਮੇਂ ਸਿਰ ਵਾਪਸ ਕਰ ਦਿਉਂਗੇ ਅਤੇ ਮੈਨੂੰ ਜ਼ਿਆਦਾ ਪਰੇਸ਼ਾਨੀ ਨਹੀਂ ਝੱਲਣੀ ਪਵੇਗੀ ਧੰਨਵਾਦ